ਸਾਡੇ ਲਈ ਭਾਰਤੀ ਫਿਲਮਾਂ ਅਤੇ ਸੰਗੀਤ ਬਹੁਤ ਮਹੱਤਵ ਰੱਖਦੇ ਹਨ ਕਿਉਂਕਿ ਭਾਰਤੀ ਫਿਲਮਾਂ ਇਸ ਤਰ੍ਹਾਂ ਦੀਆਂ ਫਿਲਮਾਂ ਹਨ ਜੋ ਕਿ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹਨ ਕੁਝ ਭਾਰਤੀ ਫਿਲਮਾਂ ਇੱਦਾਂ ਦੀਆਂ ਹਨ ਜਿਵੇਂ ਕਿ ਹਮ ਦਿਲ ਦੇ ਚੁਕੇ ਸਨਮ ਮੁਹੱਬਤੇ ਹਮ ਸਾਥ ਸਾਥ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਹਨ ਕਿ ਅਸੀਂ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹਨ ਔਰ ਮੇਰਾ ਮਨ ਪਸੰਦ ਅਭਿਨੇਤਰੀ ਨੀਰੂ ਬਾਜਵਾ ਆ ਸਾਨੂੰ ਪੰਜਾਬੀ ਫਿਲਮਾਂ ਵੀ ਬਹੁਤ ਹੀ ਵਧੀਆ ਲੱਗਦੀਆਂ ਹਨ ਅਤੇ ਜੋ ਕੀ ਬਹੁਤ ਆਨੰਦ ਦਿੰਦੀਆਂ ਹਨ ਦੇਖਣ ਨੂੰ ਵੀ ਸੋਹਣੀਆਂ ਲੱਗਦੀਆਂ ਹਨ ਫਿਲਮੀ ਗੀਤ ਮੈਨੂੰ ਸਭ ਤੋਂ ਵੱਧ ਫਿਲਮੀ ਗੀਤ ਪੰਜਾਬੀ ਫਿਲਮੀ ਗੀਤ ਵਧੀਆ ਲੱਗਦੇ ਹਨ ਔਰ ਮੇਰਾ ਪਸੰਦੀਦਾ ਗਾਇਕ ਅਮਰਿੰਦਰ ਗਿੱਲ ਹੈ ਮੇਰੀ ਪਸੰਦ ਦੀ ਅਭਿਨੇਤਰੀ ਨੀਰੂ ਬਾਜਵਾ ਹੈ ਅਦਾਕਾਰ ਸਲਮਾਨ ਖਾਨ ਹੈ ਇਹਨਾਂ ਦੀਆਂ ਫਿਲਮਾਂ ਬਹੁਤ ਹੀ ਵਧੀਆ ਅਤੇ ਬਹੁਤ ਹੀ ਸੋਹਣੀਆਂ ਹੁੰਦੀਆਂ ਹਨ ਜੋ ਕਿ ਅਸੀਂ ਆਪਣੇ ਪੂਰੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹਨ ਪਹਿਲੇ ਟਾਈਮ ਦੀਆਂ ਪੁਰਾਣੀਆਂ ਫਿਲਮਾਂ ਅੱਜ ਦੇ ਟਾਈਮ ਨਾਲੋਂ ਕਾਫੀ ਵਧੀਆ ਸੀ ਜੋ ਕਿ ਅਸੀਂ ਪੂਰਾ ਫੈਮਲੀ ਇਕੱਠੇ ਹੋ ਕੇ ਇੱਕ ਕਮਰੇ 'ਚ ਬਹਿ ਕੇ ਸਾਰੇ ਫਿਲਮਾਂ ਦੇਖ ਸਕਦੇ ਸਨ ਇਸ ਕਰਕੇ ਸਾਡੇ ਭਾਰਤ ਦੀ ਫਿਲਮਾਂ ਅਤੇ ਸੰਗੀਤ ਬਾਰੇ ਅਸੀਂ ਬਹੁਤ ਹੀ ਵਧੀਆ ਸੋਚਦੇ ਹਨ